ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਪੁਲਿਸ ਸਟੇਸ਼ਨ ਤੋਂ ਗੱਲ ਕਰ ਰਹੇ ਆ ਜੀ ਸਰ ਮੈਂ ਇਹ ਕੰਪਲੇਂਟ ਦਰਜ ਕਰਵਾਉਣੀ ਸਰ ਸਰ ਮੇਰਾ ਇੱਕ ਬੈਗ ਗੁੰਮ ਹੋ ਗਿਆ ਜੀ ਸਰ ਮੈਂ ਬੱਸ ਦੇ ਵਿੱਚ ਸਫ਼ਰ ਕਰ ਰਿਹਾ ਸੀ ਜੀ ਅਤੇ ਫਿਰ ਮੈਂ ਆਪਣਾ ਬੈਗ ਸੀਟ ਦੇ ਉੱਤੇ ਪਿਆ ਸੀਗਾ ਐਂਡ ਦੈਨ ਉੱਥੋਂ ਦੀ ਪਤਾ ਨਹੀਂ ਮਿਸਿੰਗ ਹੋ ਗਿਆ ਜੀ ਅਤੇ ਮੈਨੂੰ ਫਿਰ ਟਾਕ ਹੋ ਗਿਆ ਮੈਂ ਫਿਰ ਲੁਧਿਆਣੇ ਆ ਰਿਹਾ ਸੀ ਪਟਿਆਲੇ ਤੋਂ ਇਹ ਅਰਲੀ ਮਾਰਨਿੰਗ ਦੀ ਗੱਲ ਹੈ ਜੀ ਸਾਢੇ ਛੇ ਵਜੇ ਹਾਂਜੀ ਮੇਰਾ ਸਰ ਮੇਰਾ ਬਲੈਕ ਕਲਰ ਦਾ ਬੈਗ ਹੈ ਐਚ ਪੀ ਦਾ ਬੈਗ ਹੈ ਜੀ ਉਹ ਲੈਪਟੋਪ ਵਾਲਾ ਅਤੇ ਉਸ 'ਚ ਮੇਰਾ ਲੈਪਟੋਪ ਵੀ ਪਿਆ ਹੋਇਆ ਸੀਗਾ ਬਾਕੀ ਅ ਮੇਰੇ ਡਾਕੂਮੈਂਟ ਵਗੈਰਾ ਪਏ ਹੋਏ ਸੀ ਅਤੇ ਥੋੜ੍ਹੇ ਕੱਪੜੇ ਸੀਗੇ ਮੇਰੇ ਪੈਸੇ ਵੀ ਸੀਗੇ ਸਰ ਉਹਦੇ ਬੈਗ ਦੇ ਵਿੱਚ ਅਲ ਲਗਭਗ ਪੰਦਰਾਂ ਸੌ ਰੁਪਈਆ ਹੋਵੇਗਾ ਹਾਂਜੀ ਪੰਦਰਾਂ ਕੁ ਸੌ ਰੁਪਏ ਦੇ ਲਗਭਗ ਸੀਗਾ ਹਾਂਜੀ ਜ਼ਰੂਰੀ ਹਾਂਜੀ ਮੈਂ ਜਿਵੇਂ ਕਿ ਆਪਣਾ ਆਧਾਰ ਕਾਰਡ ਵਗੈਰਾ ਹੋ ਗਿਆ ਉਹ ਵੀ ਉਹਦੇ ਵਿੱਚ ਰੱਖੇ ਹੋਏ ਸੀ ਐਕਚੁਲੀ ਜਦੋਂ ਜੀ ਮੈਂ ਹਾਂਜੀ ਹਾਂ ਉਹ ਮੈਂ ਜਦੋਂ ਬੱਸ ਤੋਂ ਉਤਰਿਆ ਜੀ ਅਤੇ ਫਿਰ ਉਸ ਤੋਂ ਬਾਅਦ ਆਟੋ ਰਿਕਸ਼ਾ 'ਚ ਬੈਠਿਆ ਤਾਂ ਜਾਂਦੇ ਜਾਂਦੇ ਹੀ ਰਸਤੇ 'ਚ ਇੱਕਦਮ ਮੇਰੇ ਦਿਮਾਗ 'ਚ ਆਇਆ ਵੀ ਮੇਰਾ ਬੈਗ ਮੇਰੇ ਨਾਲ ਹੈ ਨਹੀਂ ਅਤੇ ਤਾਂ ਕਰਕੇ ਫਿਰ ਉਹ ਨਹੀਂ ਜਦੋਂ ਮੈਂ ਰਿਕਸ਼ਾ ਦੇ ਵਿੱਚ ਜਾ ਰਿਹਾ ਸੀਗਾ ਨਾ ਜੀ ਉਦੋਂ ਇੱਕਦਮ ਯਾਦ ਆਇਆ ਅਤੇ ਪਰ ਫਿਰ ਉਦੋਂ ਤੱਕ ਬੱਸ ਚੱਲੀ ਗਈ ਸੀਗੀ ਹਾਂਜੀ ਮੈਨੂੰ ਜੀ ਸਰ ਦੋ ਘੰਟੇ ਲੱਗਦੇ ਹੈ ਸਿਰਫ ਦੋ ਘੰਟੇ ਲੱਗਦੇ ਹੈ ਤਾਂ ਫਿਰ ਮੈਂ ਬੱਸ ਤੋਂ ਉਤਰਿਆ ਦੋ ਘੰਟੇ ਮੈਂ ਓਲਮੋਸਟ ਮੈਂ ਪੌਣੇ ਅੱਠ ਵਜੇ ਉਤਰ ਗਿਆ ਹਜੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਮੈਂ ਬਸ ਦਾ ਪਤਾ ਵਗੈਰਾ ਵੀ ਕਰ ਰਿਹਾ ਸੀ ਜੀ ਅਤੇ ਪਰ ਉੱਥੇ ਮੈਨੂੰ ਹੁਣ ਨੰਬਰ ਯਾਦ ਨਹੀਂ ਸੀ ਮੇਰੀ ਟਿਕਟ ਦੀ ਪਰਚੀ ਹੁਣ ਗੁੰਮ ਗਈ ਹੈ ਅਤੇ ਪਰ ਉੱਥੇ ਜੀ ਨਾਲ ਲਾਗੇ ਤਾਗੇ ਸੀ ਸੀ ਟੀ ਵੀ ਕੈਮਰਾ ਲੱਗੇ ਹੋਏ ਸੀ ਅਤੇ ਉੱਥੋਂ ਜਾਣਕਾਰੀ ਸ਼ਾਇਦ ਤੁਹਾਨੂੰ ਪਤਾ ਲੱਗ ਸਕਦੀ ਹੈ ਜੀ ਬੱਸ ਸਟੇਸ਼ਨ 'ਤੇ ਲੁਧਿਆਣਾ ਲੁਧਿਆਣਾ ਬੱਸ ਅੱਡਾ ਹੀ ਸੀ ਜੀ ਹਾਂਜੀ ਹਾਂਜੀ ਹਾਂਜੀ

ਜੀ ਜੀ ਜੀ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਰ ਇਹ ਹੀ ਵਾਲਾ ਨੰਬਰ ਮੇਰਾ ਨੋਟ ਕੀਤਾ ਜਾਵੇ ਜੀ ਮੈਂ ਇਹ 'ਤੇ ਅਵੇਲੇਵਲ ਹੋਉਂਗਾ ਠੀਕ ਹੈ ਠੀਕ ਹੈ ਜੀ ਓਕੇ ਓਕੇ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਥੈਂਕ ਯੂ ਸਰ